ਮੈਂ ਅਕਸਰ ਹੀ ਜਿਹੜੀਆਂ ਹੁਣ ਤੱਕ ਲਿਖਿਆ ਉਹ ਵਾਤਾਵਰਨ ਬਾਰੇ ਲਿਖਿਆ ਸੱਭਿਆਚਾਰ ਬਾਰੇ ਲਿਖਿਆ ਫਿਰ ਵੀ ਮੈਨੂੰ ਐਂ ਲੱਗਦਾ ਹੈ ਵੀ ਮੈਂ ਹੋਰ ਲੋਕ ਗੀਤਾਂ ਬਾਰੇ ਵੀ ਲਿਖ ਸਕਦਾ ਹਾਂ ਕਿਉਂਕਿ ਲੋਕ ਗੀਤ ਜੋ ਆ ਉਹ ਨਵੀਂ ਪੀੜ੍ਹੀ ਨੂੰ ਇੱਕ ਟੀਕੇ ਦੇ ਰੂਪ ਦੇ ਵਿੱਚ ਕੰਮ ਕਰਦੇ ਹਨ ਜੋ ਨਵੀਂ ਪੀੜ੍ਹੀ ਹੈ ਇਹ ਕਿਤਾਬਾਂ ਪੜ੍ਹਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਇਹਨਾਂ ਨੂੰ ਪੜ੍ਹਾਈ ਪੜ੍ਹਨਾ ਬੜਾ ਔਖਾ ਲੱਗਦਾ ਹੈ ਇਹ ਜੋ ਸਿਰਫ ਵੇਖ ਕੇ ਆਪਦਾ ਮਨੋਰੰਜਨ ਕਰਨਾ ਚਾਹੁੰਦੀ ਹੈ ਅਤੇ ਜੋ ਲੋਕ ਗੀਤ ਹਨ ਜੋ ਸਾਡੇ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹਨ ਇਕ ਟੀਕੇ ਦੀ ਤਰ੍ਹਾਂ ਜੋ ਇੱਕ ਸਰੀਰ 'ਤੇ ਅਸਰ ਕਰਦੇ ਹਨ ਇਸ ਕਰਕੇ ਮੈਂ ਚਾਹੁੰਦਾ ਹਾਂ ਮੈਂ ਲੋਕ ਗੀਤਾਂ ਦੇ ਵਿੱਚ ਆਪਦੀ ਪਕੜ ਬਣਾਵਾਂ ਲੋਕ ਗੀਤ ਜਿਹੜੇ ਆ ਉਹ ਬੜੇ ਹੀ ਆਪਣਾ ਹ ਸਮਾਜ ਦੇ ਵਿੱਚ ਸੁਣੇ ਜਾਂਦੇ ਹਨ ਬਜਾਏ ਨਵੀਂ ਪੀੜ੍ਹੀ ਕਿਤਾਬਾਂ ਪੜ੍ਹਨ ਦੀ ਥਾਂ 'ਤੇ ਇਹਨਾਂ ਨੂੰ ਸੁਣਨਾ ਜ਼ਿਆਦਾ ਪਸੰਦ ਕਰਦੀ ਹੈ ਇਸ ਕਰਕੇ ਮੇਰਾ ਜੋ ਹੁਣ ਆਉਣ ਵਾਲਾ ਮੈਂ ਚਾਹੁੰਦਾ ਹਾਂ ਕਿ ਮੈਂ ਲੋਕ ਗੀਤਾਂ ਬਾਰੇ ਕੁਛ ਨਾ ਕੁਛ ਲਿਖਾਂ